ਨਮਸਤੇ ਅੱਛਾ ਜੀ ਹਾਂਜੀ ਸਕੂਲ ਤਾਂ ਬਥੇਰੇ ਹੈ ਇੱਥੇ ਹੁਸ਼ਿਆਰਪੁਰ ਦੇ ਵਿੱਚ ਕਿੰਨੇ ਸਾਲ ਦਾ ਬੱਚਾ ਤੁਹਾਡਾ ਠੀਕ ਆ ਮੈਂ ਨਾ ਆਪਣਾ ਬੱਚਾ ਪਾਇਆ ਆ ਇੱਥੇ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਹਾਂਜੀ ਹੁਸ਼ਿਆਰਪੁਰ ਤੋਂ ਟਾਂਡਾ ਰੋਡ 'ਤੇ ਆ ਹਰਕ੍ਰਿਸ਼ਨ ਪਬਲਿਕ ਸਕੂਲ ਅਤੇ ਫੀਸ ਵੀ ਠੀਕ ਹੈ ਉਹਨਾਂ ਦੀ ਪੰਦਰਾਂ ਕੁ ਸੌ ਰੁਪਈਆ ਹੈ ਮਹੀਨੇ ਦੀ ਪੜ੍ਹਾਈ ਵੀ ਠੀਕ ਆ ਉਨ੍ਹਾਂ ਦੀ ਅਤੇ ਬਾਕੀ ਜੇ ਪ੍ਰੈਮਰੀ ਸਕੂਲ ਵੀ ਵਧੀਆ ਜੇ ਤੁਸੀਂ ਪ੍ਰੈਮਰੀ 'ਚ ਪਾਉਣਾ ਤਾਂ ਸਕੂਲ ਓਫ ਐਮੀਨੈੱਸ ਤਾਂ ਫਿਰ ਆਪਣੇ ਇੱਥੇ ਨਾਲ ਹੀ ਇੱਕ ਹੋਰ ਹੈ ਦੋ ਕਿਲੋਮੀਟਰ 'ਤੇ ਏ ਟ੍ਰਿੰਨੀਟੀ ਅਤੇ ਉਸ ਤੋਂ ਬਾਅਦ ਹੈਗਾ ਇੱਕ ਨਵਾਂ ਸਕੂਲ ਖੁੱਲ੍ਹਿਆ ਨੋਰਥ ਈ ਨੋਰਥ ਈਸਟ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਦੀ ਪੈਂਤੀ ਕੁ ਸੌ ਰੁਪਈਆ ਫੀਸ ਹੈ ਮਹੀਨੇ ਦੀ ਹਾਂਜੀ ਅਤੇ ਸਾਲ ਦਾ ਐਨੂਅਲ ਚਾਰਜ ਹੈਗੇ ਦਸ ਹਜ਼ਾਰ ਅਤੇ ਇੱਥੇ ਜਿੱਥੇ ਮੈਂ ਪਾਇਆ ਸਭ ਤੋਂ ਸਸਤਾ ਇਹ ਹੀ ਆ ਇਹ ਪੰਦਰਾਂ ਕੁ ਸੌ ਰੁਪਈਆਂ ਸੋਲਾਂ ਸੌ ਰੁਪਈਆ ਮਹੀਨੇ ਦੀ ਫੀਸ ਆ ਬੱਸ ਵਗੈਰਾ ਵੀ ਲੱਗੀ ਓ ਆ ਮੈਨੂੰ ਤਾਂ ਚੱਲ ਲਾਗੇ ਪੈਂਦਾ ਮੈਂ ਤਾਂ ਸਕੂਟਰ 'ਤੇ ਸੈਕਲ 'ਤੇ ਵੀ ਛੱਡ ਆਉਂਦਾ ਉਹਨੂੰ ਹਾਂ ਹੁਣ ਸਰਕਾਰੀ ਵੀ ਵਧੀਆ ਸ ਹਾਂ ਸਕੂਲ ਓਫ ਐਮੀਨੈੱਸ ਖੁੱਲ੍ਹੇ ਆ ਭਗਵੰਤ ਮਾਨ ਸਰਕਾਰ ਨੇ ਚਲਾਏ ਆ ਵਧੀਆ ਟੀਚਰ ਆ ਉੱਥੇ ਵੀ ਅਤੇ ਸਾਰੇ ਸਬਜੈਕਟ ਆ ਉੱਥੇ ਵੀ ਅਤੇ ਬਾਕੀ ਸਕੂਲ ਬੱਸਾਂ ਵੀ ਲੱਗੀਆਂ ਉੱਥੇ ਜੇ ਬੱਸਾਂ 'ਚ ਭੇਜਣਾ ਤੁਸੀਂ ਬੱਚਿਆਂ ਬੱਚਿਆਂ ਨੂੰ ਬੱਸ 'ਚ ਵੀ ਭੇਜ ਸਕਦੇ ਹਾਂ ਜੇ ਓਦਾਂ ਜਾਣਾ ਤਾਂ ਓਦਾਂ ਵੀ ਜਾ ਸਕਦੇ ਆ ਮੈਂ ਤਾਂ ਤਿੰਨ ਕੁ ਸਾਲ ਸੀ ਜੀ ਓਦੋਂ ਲਾ ਤਾਂ ਸੀਗਾ ਅਤੇ ਪੜ੍ਹਾਈ ਤਾਂ ਵਧੀਆ ਹੁੰਦੀ ਆ ਅਤੇ ਜਿਸ ਜੇ ਹੁਣ ਦੇਖੋ ਤੁਸੀਂ ਪ੍ਰੈਮਰੀ 'ਚ ਪਾਉਣਾ ਕਿ ਪ੍ਰਾਈਵੇਟ 'ਚ ਪਾਉਣਾ ਆਹੋ ਤੁਹਾਡਾ ਪਿੰਡ ਵੀ ਲਾਗੇ ਹੀ ਆ ਤੁਸੀਂ ਕਰ ਸਕਦੇ ਹੈ ਉੱਥੋਂ ਵੀ ਬੱਚੇ ਨੂੰ ਆਪ ਵੀ ਛੱਡ ਸਕਦੇ ਆ ਜੇ ਬੱਸ 'ਚ ਭੇਜਣਾ ਤਾਂ ਫਿਰ ਉਹਦੇ ਫਿਰ ਚਾਰਜਸ ਥੋੜ੍ਹੇ ਜ਼ਿਆਦਾ ਹੁੰਦੇ ਆ

ਹਾਂ ਫਿਰ ਉਹ ਹੀ ਬੱਸ ਦੇ ਚਾਰਜਸ ਨਹੀਂ ਪਾਉਣੇ ਉਨ੍ਹਾਂ ਨੇ ਟਰਾਂਸਪੋਰਟੇਸ਼ਨ ਅਤੇ ਬਾਕੀ ਟ੍ਰਿਨਿਟੀ ਸਕੂਲ ਵੀ ਹੈਗਾ ਆ ਅਤੇ ਬਾਕੀ ਜਿਹੜੇ ਇਹ ਸਕੂਲ ਹੈ ਸੀ ਬੀ ਐਸ ਈ ਬੋਰਡ ਦੇ ਆ ਜਿੱਥੇ ਮੈਂ ਪਾਇਆ ਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੀਨੀਅਰ ਸੈਕੰਡਰੀ ਸਕੂਲ ਹੈ ਪਲਸ ਟੂ ਤੱਕ ਹੂੰ ਇਹ ਪ੍ਰੀ ਨਰਸਰੀ ਤੋਂ ਅਤੇ ਜਿਹੜਾ ਹੈਗਾ ਦੂਜਾ ਨੋਰਥ ਜਿਹੜਾ ਦੱਸਿਆ ਉਹ ਹਜੇ ਨਵਾਂ ਖੁੱਲ੍ਹਿਆ ਸਕੂਲ ਅਤੇ ਉਹ ਹਜੇ ਕਲਾਸਸ ਹਜੇ ਥੋੜ੍ਹੀਆਂ ਹੈ ਮੇਰੇ ਖ਼ਿਆਲ 'ਚ ਫਿਫਥ ਤੱਕ ਆ ਉਹ ਉਨ੍ਹਾਂ ਨੇ ਅਪਗ੍ਰੇਡ ਕਰਵਾਉਣਾ ਹਜੇ ਹਾਂਜੀ ਹਾਂਜੀ ਚੱਲੋ ਦੇਖ ਲਓ ਫਿਰ ਤੁਸੀਂ ਜਿੱਥੇ ਜੇ ਸਲਾਹ ਕਰ ਲਓ ਫਿਰ ਫਿਰ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਕੰਟੈਕਟ ਨੰਬਰ ਸੈਂਡ ਕਰ ਦਾਂਗਾ ਠੀਕ ਹੈ ਜੀ ਥੈਂਕ ਊ ਜੀ ਧੰਨਵਾਦ